ਅਸੀਂ ਸਾਲ ਦੇ ਵਿੱਚ ਬਹੁਤ ਸਾਰੇ ਸੱਭਿਆਚਾਰਕ ਤਿਉਹਾਰ ਅਤੇ ਸਮਾਗਮ ਮਨਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਦੀਵਾਲੀ ਦੁਸਹਿਰਾ ਲੋਹੜੀ ਵਿਸਾਖੀ ਬਸੰਤ ਪੰਚਮੀ ਬਹੁਤ ਸਾਰੇ ਗੁਰਪੁਰਬ ਨਾਗ ਪੰਚਮੀ ਆਦਿ ਆਉਂਦੇ ਹਨ ਅਤੇ ਇਸ ਦੇ ਵਿੱਚ ਜਿਹੜਾ ਲੋਹੜੀ ਦਾ ਤਿਉਹਾਰ ਹੈ ਉਹ ਰਾਤ ਨੂੰ ਘਰਾਂ ਦੇ ਵਿੱਚ ਅੱਗ ਬਾਲ ਕੇ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਤਿਲ ਰਿਊੜੀ ਮੂੰਗਫਲੀ ਮਖਾਣੇ ਆਦਿ ਪਾ ਕੇ ਅੱਗ ਦੇ ਦੁਆਲੇ ਘੁੰਮ ਕੇ ਇਸ ਨੂੰ ਮਨਾਇਆ ਜਾਂਦਾ ਹੈ ਉਸ ਤੋਂ ਬਆਦ ਬਸੰਤ ਪੰਚਮੀ ਦੇ ਤਿਉਹਾਰ 'ਤੇ ਪੀਲੇ ਰੰਗ ਦਾ ਕੜਾਹ ਜਾਂ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ ਅਤੇ ਲੋਕ ਪੀ ਅਹ ਗੱਭਰੂ ਪੀਲੀਆਂ ਪੱਗਾਂ ਬੰਨ੍ਹਦੇ ਹਨ ਅਤੇ ਮੁਟਿਆਰਾਂ ਪੀਲੇ ਸੂਟ ਪਾਉਂਦੀਆਂ ਹਨ ਇਸ ਤੋਂ ਇਲਾਵਾ ਵਿਸਾਖੀ ਦਾ ਤਿਉਹਾਰ ਕਣਕ ਦੀ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਉਹਾਰ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਦੀਵਾਲੀ ਆਉਦੀਂ ਅਹ ਦੀਵਿਆਂ ਦੀ ਰਾਤ ਉਸ ਦਿਨ ਰਾਮ ਚੰਦਰ ਜੀ ਆ ਜੋ ਉਹ ਆਪਣੇ ਘਰ ਵਾਪਸ ਆਏ ਸੀ ਜਿਸ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਘੀ ਦੇ ਦੀਵੇ ਬਾਲ ਕੇ ਦੀਵਾਲੀ ਦਾ ਦਿ ਤਿਉਹਾਰ ਮਨਾਇਆ ਸੀ ਅਤੇ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਉਹ ਰਿਹਾਅ ਹੋ ਕੇ ਆਏ ਸਨ ਜਿਸ ਦੀ ਖੁਸ਼ੀ ਦੇ ਵਿੱਚ ਸਿੱਖਾਂ ਨੇ ਘੀ ਦੇ ਦੀਵੇ ਬਾਲ ਕੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਪਾਵਲੀ ਮਨਾਈ ਦੁਸਹਿਰੇ ਦਾ ਤਿਉਹਾਰ ਸਭ ਨੂੰ ਪਤਾ ਹੀ ਹੈ ਕਿ ਦਸ ਸਿਰਾਂ ਵਾਲੇ ਰਾਵਣ ਦੇ ਅੰਤ ਦੇ ਦਿਨ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਗੁਰਪੁਰਬ ਜਿਸ ਦਿਨ ਕਿਸੇ ਵੀ ਗੁਰੂ ਜੀ ਦਾ ਪ੍ਰਕਾਸ਼ ਹੋਇਆ ਉਨ੍ਹਾਂ ਦੇ ਤਿਉਹਾ ਉਸ ਦਿਨ ਨੂੰ ਗੁਰਪੁਰਬ ਦੇ ਰੂਪ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਤਮਸਤਕ ਹੋ ਕੇ ਸੇਵਾ ਕਰਕੇ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੋ ਕਿ ਨਾਗਾਂ ਦੇ ਲਈ ਇੱਕ ਪਵਿੱਤਰ ਦਿਨ ਦੀ ਤਰ੍ਹਾਂ ਹੁੰਦਾ ਹੈ ਉਸਨੂੰ ਪੂਜ ਕੇ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਤਿਉਹਾਰ ਹੋਰ ਵੀ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਰੱਖੜੀ ਦਾ ਤਿਉਹਾਰ ਜੋ ਕਿ ਭੈਣ ਭਰਾ ਦੇ ਪਿਆਰ ਦਾ ਇੱਕ ਸੰਕੇਤ ਹੁੰਦਾ ਹੈ ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਅਤੇ ਉਸ ਨੂੰ ਇਹ ਉਸ ਤੋਂ ਇਹ ਵਰ ਪ੍ਰਾਪਤ ਕਰਦੀ ਹੈ ਇੱਕ ਤਰ੍ਹਾਂ ਦਾ ਕਿ ਉਹ ਮੇਰੀ ਹਰ ਵਾਰ ਰੱਖਿਆ ਕਰੇਗਾ ਅਤੇ ਇਹ ਆਪਸੀ ਪਿਆਰ ਦਾ ਪ੍ਰਤੀਕ ਹੈ ਇਸ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਵੱਖ ਵੱਖ ਧਰਮਾਂ ਦੇ ਵੱਖ ਵੱਖ ਭਾਈਚਾਰੇ ਅਤੇ ਸੱਭਿਆਚਾਰਾਂ ਦੇ ਆਪਣੇ ਆਪਣੇ ਤਿਉਹਾਰ ਅਤੇ ਸਮਾਗਮ ਹਨ ਅਤੇ ਸਭ ਲੋਕ ਇਸਨੂੰ ਬਹੁਤ ਖੁਸ਼ੀ ਅਤੇ ਧੂਮ ਧਾਮ ਦੇ ਨਾਲ ਮਨਾਉਂਦੇ ਹਨ